ਹਰੇਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਏ ਆ ਜਿਹਨਾਂ ਨੂੰ ਪਾਰ ਪਾਉਣਾ ਸਾਡੇ ਲਈ ਚੁਣੌਤੀ ਦਾ ਵਿਸ਼ਾ ਹੁੰਦਾ ਏ ਆ ਮੈਂ ਜ਼ਿੰਦਗੀ ਦੇ ਵਿੱਚ ਪੜ੍ਹਾਈ ਕਰਦੇ ਸਮੇਂ ਮੈਨੂੰ ਉਸ ਵੇਲੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹਾਂ ਅਤੇ ਮੇਰੇ ਮਾਪਿਆਂ ਦੇ ਕੋਲ ਇੰਨਾਂ ਪੈਸਾ ਨਹੀਂ ਸੀ ਕਿ ਉਹ ਮੈਨੂੰ ਪੜ੍ਹਾ ਸਕਣ ਪਰ ਫਿਰ ਵੀ ਮੈਂ ਇੱਕ ਪਾਰਟ ਟਾਈਮ ਜੋਬ ਕਰਦੇ ਨਾਲ ਨਾਲ ਇੱਕ ਪੜ੍ਹਨ ਪੜ੍ਹਾਈ ਵੀ ਆਪਣੀ ਜਾਰੀ ਰੱਖੀ ਜਿਹਦੇ ਨਾਲ ਮੈਂ ਅੱਜ ਸੁਖੰਦ ਮਹਿਸੂਸ ਕਰ ਰਿਹਾ ਏ ਆ ਮੈਨੂੰ ਪੜ੍ਹਾਈ ਕਰਦੇ ਸਮੇਂ ਮੈਨੂੰ ਪੈਸਿਆਂ ਦੀ ਦਿੱਕਤ ਆਉਂਦੀ ਸੀ ਤਾਂ ਮੈਂ ਕਿਸੇ ਡਾਕਟਰ ਦੇ ਨਾਲ ਜ ਕਲੀਨਿਕ 'ਤੇ ਲੱਗਾ ਹੋਇਆ ਸੀਗਾ ਅਤੇ ਉਹ ਮੈਨੂੰ ਕੁਝ ਪੈਸੇ ਦੇ ਦਿੰਦਾ ਸੀਗਾ ਜਿਹਦੇ ਨਾਲ ਮੈਂ ਆਪਣਾ ਜੀਵਨ ਸੁਖੰਦ ਅਤੇ ਆਪਣੀ ਪੜ੍ਹਾਈ ਜਾਰੀ ਰੱਖੀਆਂ ਉਸ ਤੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਮੈਨੂੰ ਜੋਬ ਲਈ ਦਿੱਕਤ ਆਉਂਦੀ ਪਈ ਸੀਗੀ ਅਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਅੱਗੇ ਪੜ੍ਹਾਂ ਪਰ ਘਰ ਦੀਆਂ ਮੁਸ਼ਕਿਲਾਂ ਦੇ ਕਾਰਨ ਮੈਂ ਅੱਗੇ ਨਹੀਂ ਪੜ੍ਹ ਸਕਿਆ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਅਤੇ ਉਸ ਤੋਂ ਬਾਅਦ ਕੋਈ ਨਾ ਕੋਈ ਕੰਮ ਕਰਨਾ ਸ਼ੁਰੂ ਕੀਤਾ ਮੈਂ ਉਸ ਤੋਂ ਬਾਅਦ ਇੱਕ ਕੰਪਿਊਟਰ ਸੈਂਟਰ ਖੋਲ੍ਹਿਆ ਕੰਪਿਊਟਰ ਸੈਂਟਰ ਖੋਲ੍ਹਦੇ ਸਮੇਂ ਵੀ ਮੈਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਹਦੇ ਨਾਲ ਮੇਰੇ ਪੈਸਿਆਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਅਤੇ ਮੈਨੂੰ ਲੋਨ ਲੈ ਕੇ ਇੱਕ ਕੰਪਿਊਟਰ ਸੈਂਟਰ ਚਲਾਉਣਾ ਪਿਆ ਅਤੇ ਉਹ ਪਰ ਮੰਥਲੀ ਮੈਨੂੰ ਉਹਦੀ ਕਿਸ਼ਤ ਪੇ ਕਰਨੀ ਪੈਂਦੀ ਸੀਗੀ ਮੈਂ ਉਸ ਤੋਂ ਬਾਅਦ ਵੀ ਇੰਨਾਂ ਮੈਨੂੰ ਵਧੀਆ ਨਹੀਂ ਲੱਗਾ ਕਿ ਮੇਰੀ ਜ਼ਿੰਦਗੀ ਬੜੀ ਕੋਈ ਸਫਲ ਲੱਗਦੀ ਪਈ ਆ ਆਪਣੇ ਵੱਲੋਂ ਤਾਂ ਵਧੀਆ ਮਿਹਨਤ ਕੀਤੀ ਕਿ ਉਹਨੂੰ ਸਫਲ ਬਣਾਈਏ ਉਸ ਤੋਂ ਬਾਅਦ ਇੱਕ ਮੈਂ ਮੈਡੀਕਲ ਰੈਪ ਦੀ ਜੋਬ ਕੀਤੀ ਅਤੇ ਉਹ ਵੀ ਘੁੰਮਣ ਘੇਰੀਆਂ ਕਦੇ ਇਸ ਸ਼ਹਿਰ ਅਤੇ ਕਦੇ ਉਸ ਸ਼ਹਿਰ ਡਾਕਟਰਾਂ ਨੂੰ ਮੈਡੀਸਨ ਇੰਟਰੋਡਿਊਸ ਕਰਾਉਣੀ ਪੈਂਦੀ ਹੁੰਦੀ ਸੀ ਅਤੇ ਸਾਨੂੰ ਕਈ ਵੇਲੇ ਕੁਛ ਰਾਤ ਹੋ ਜਾਂਦੀ ਸੀਗੀ ਕਿਤੇ ਗਏ ਹੋਏ ਅਤੇ ਉਹਦੇ ਨਾਲ ਦੇ ਘਰਦਿਆਂ ਨੂੰ ਪਰੇਸ਼ਾਨੀ ਹੁੰਦੀ ਸੀਗੀ ਕਿ ਅਜੇ ਤੱਕ ਸਾਡਾ ਲੜਕਾ ਨਹੀਂ ਆਇਆ ਹੈਗਾ ਜ਼ਿੰਦਗੀ ਨੂੰ ਬਣਾਉਣ ਦੇ ਲਈ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਮੈਂ ਹੁਣ ਭਾਵੇਂ ਅੱਜ ਕੱਲ੍ਹ ਇੱਕ ਕਲੈਰੀਕਲ ਜੋਬ ਕਰਦਾ ਪਿਆ ਹਾਂ ਪਰ ਮੈਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਗੁਜ਼ਾਰਨ ਅਤੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਆ ਉਹਨਾਂ ਦਾ ਸਾਹਮਣਾ ਕਰਨਾ ਸਾਡੇ ਲਈ ਇੱਕ ਬਹੁਤ ਹੀ ਇੱਕ ਬੁਰਾ ਅਨੁਭਵ ਲੱਗਦਾ ਏ ਆ ਪਰ ਜਦੋਂ ਅਸੀਂ ਸਫਲ ਹੋ ਜਾਦੇ ਹਾਂ ਸਾਨੂੰ ਲੱਗਦਾ ਆ ਕਿ ਸਾਡੀ ਜ਼ਿੰਦਗੀ ਸਾਰਥਕ ਹੋ ਗਈ ਕਿ ਅਸੀਂ ਹੁਣ ਸਫਲ ਹੋ ਗਏ ਹਾਂ ਅਸੀਂ ਚਾਹੁੰਦੇ ਹਾਂ ਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਹ ਹਰੇਕ ਦੀ ਜ਼ਿੰਦਗੀ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਉਹ ਮੁਸ਼ਕਿਲਾਂ ਨੂੰ ਹੱਲ ਕਰਨਾ ਉਹ ਬੰਦੇ ਦਾ ਹੱਕ ਬਣਦਾ ਏ ਆ ਜੇ ਉਹਨੇ ਸਫਲ ਹੋਣਾ ਹੈ ਅਗਰ ਜੇ ਤੁਸੀਂ ਸਫਲ ਹੋਣ ਲਈ ਮਿਹਨਤ ਕਰਦੇ ਹਾਂ ਅਤੇ ਤੁਹਾਨੂੰ ਸਫਲਤਾ ਮਿਲੇਗੀ